ਬਹੁਤ ਸਾਰੀਆਂ ਪ੍ਰੰਪਰਾਗਤ ਖੇਡਾਂ ਨੇ ਜਿਨ੍ਹਾਂ ਬਾਰੇ ਸੈਲਾਨੀ ਜਾਣਨਾ ਚਾਹੁੰਣਗੇ ਕਿਉਂਕਿ ਅੱਜ ਕੱਲ੍ਹ ਹਰ ਕਿਸੇ ਨੂੰ ਹੁੰਦੇ ਹੈ ਕਿ ਅਸੀਂ ਨਵੀਂ ਨਵੀਂ ਜਾਣਕਾਰੀ ਲਈਏ ਅਤੇ ਉਹਦੇ ਅੱਗੇ ਅਸੀਂ ਵਧੀਏ ਦੇਖੋ ਹਰ ਇਨਸਾਨ ਆਪਣੀ ਜ਼ਿੰਦਗੀ ਵਿੱਚ ਚਾਹੁੰਦਾ ਹੈ ਕਿ ਮੈਂ ਅੱਗੇ ਵਧਾਂ ਕੋਈ ਨਵੀਂ ਜਾਣਕਾਰੀ ਲਵਾਂ ਇਸ ਕਰਕੇ ਇਹ ਜਾਣਕਾਰੀ ਸੈਲਾਨੀਆਂ ਨੂੰ ਹੋਣਾ ਬਹੁਤ ਜਰੂਰੀ ਹੈ ਜਿਵੇਂ ਤੁਸੀਂ ਮੰਨ ਲਓ ਕਿ ਪੰਜਾਬ ਵਿੱਚ ਕੁਸ਼ਤੀ ਬੜੀ ਮਸ਼ਹੂਰ ਹੈ ਮਹਾਰਾਸ਼ਟਰ ਵਿੱਚ ਲੇਜ਼ਿਮ ਤਮਿਲਨਾਡੂ ਚਲੇ ਜਾਓ ਤੁਸੀਂ ਉੱਥੇ ਜਲੀ ਕੱਢੂ ਹੁੰਦਾ ਅਸਾਮ ਵਿੱਚ ਚਲੇ ਜਾਓ ਤੇ ਧੁੱਪ ਖੇਡ ਹੁੰਦਾ ਹਾਂ ਸਾਡੇ ਸਾਡਾ ਸ਼ੇਤਰ ਪੰਜਾਬ ਆਉਂਦਾ ਅੰਮ੍ਰਿਤਸਰ ਆਉਂਦਾ ਇੱਥੇ ਕਹਿ ਲਉ ਕਿ ਕੁਸ਼ਤੀ ਬੜੀ ਮਸ਼ਹੂਰ ਹੈ ਜਗ੍ਹਾ ਜਗ੍ਹਾ ਅਖਾੜੇ ਲੱਗਦੇ ਰਹਿੰਦੇ ਨੇ ਕੁਸ਼ਤੀਆਂ ਦੇ ਉੱਥੇ ਲੋਕ ਆਪਣੀਆਂ ਕੁਸ਼ਤੀਆਂ ਖੇਡਦੇ ਨੇ ਅਤੇ ਸਿੱਖਣ ਵਾਲੇ ਉਥੋਂ ਬਹੁਤ ਕੁਝ ਸਿੱਖਦੇ ਹੀ ਨੇ ਹੁਣ ਅੱਜ ਕੱਲ੍ਹ ਤਾਂ ਕਹਿ ਲਉ ਕਿ ਇਹ ਸਾਡੀ ਪੰਜਾਬ ਦੀ ਵੱਡੀ ਖੇਡ ਬਣ ਗਈ ਹੈ ਕੁਸ਼ਤੀ ਜਗ੍ਹਾ ਜਗ੍ਹਾ ਕਹਿ ਲਉ ਹਰ ਕਿਸੇ ਦੇ ਮਨ 'ਚ ਹੁੰਦਾ ਹੈ ਕਿ ਮੈਂ ਵੀ ਦੇਖਾਂ ਕਿ ਕੀ ਕਰ ਰਹੇ ਨੇ ਜਗ੍ਹਾ ਜਗ੍ਹਾ ਹੁਣ ਪੰਜਾਬ 'ਚ ਹੋਰ ਵੀ ਕਈ ਖੇਡਾਂ ਆਈ ਜਾ ਰਹੀਆਂ ਲੇਕਿਨ ਜੋ ਪੁਰਾਣੀਆਂ ਖੇਡਾਂ ਨੇ ਸੋ ਪੁਰਾਣੀਆਂ ਹੀ ਨੇ ਜੋ ਲਗਾਉ ਲੋਕਾਂ ਨੂੰ ਪੁਰਾਣੀਆਂ ਸੱਭਿਆਚਾਰਕ ਪ੍ਰੰਪਰਾਗਤ ਖੇਡਾਂ ਨਾਲ ਹੈ ਉਹ ਉਹਨਾਂ ਨਾਲ ਹੀ ਹੈ